ਬਿਮਾਰੀਆਂ ਤੋਂ ਬਚਣ ਲਈ ਮੈਂ ਖੇਡਾਂ ਖੇਡਦਾ ਆ ਜਿੰਮ ਜਾਂਦਾ ਹੈ ਜਿਵੇਂ ਬਿਮਾਰੀਆਂ ਦੀ ਰੋਕਥਾਮ ਲਈ ਜੇ ਦੇਖਿਆ ਜਾਵੇ ਤਾਂ ਅਸੀਂ ਘਰੇਲੂ ਚੀਜ਼ਾਂ ਵਰਤ ਕੇ ਮੈਂ ਇਹਨਾਂ ਨੂੰ ਠੀਕ ਕਰਦੇ ਜਿਵੇਂ ਗੈਸ ਦੀ ਪਰੋਬਲਮ ਹੋ ਜਾਂਦੀ ਹੈ ਅਜਵੈਣ ਵਿੱਚ ਲੂਣ ਮਿਲਾ ਕੇ ਦੇ ਦਿੰਦੇ ਆ ਜੇ ਕਬਜ ਹੋ ਜੇ ਤਾਂ ਚੂਰਨ ਖਾ ਕੇ ਅਸੀਂ ਘਰੇਲੂ ਚੂਰਨ ਬਣਾਇਆ ਵਾ ਉਹਨੂੰ ਹੈ ਕੇ ਠੀਕ ਹੋ ਜਾਂਦੇ ਆ ਜੇ ਖੰਘ ਵਗੈਰਾ ਹੈ ਤਾਂ ਅਦਰਕ ਦੀ ਚਟਨੀ ਜਾਂ ਅਦਰਕ ਦਾ ਰਸ ਮਿੱਠੇ ਵਿੱਚ ਮਿਲਾ ਕੇ ਹਲਕਾ ਜਾ ਸ਼ਹਿਦ ਵਿੱਚ ਮਿਲਾ ਕੇ ਅਸੀਂ ਉਹ ਖਾ ਲੈਂਦਾ ਆ ਜਿਸ ਨਾਲ ਕਿ ਸਾਡੇ ਸਥਾਨਕ ਤਰੀਕੇ ਪੂਰੇ ਹੁੰਦੇ ਆ